ਮੇਰਾ ਪਸੰਦੀਦਾ ਤੈਰਾਕੀ ਮੰਜ਼ਿਲ ਸਵਿਮਿੰਗ ਪੂਲ ਹੈ ਜੋ ਕਿ ਘਨੋਲੀ ਅਲੀਪੁਰ ਵਿੱਚ ਸਵਿਮਿੰਗ ਪੂਲ ਬਣਿਆ ਹੋਇਆ ਹੈ ਅਤੇ ਮੇਰੇ ਰੋਪੜ ਸ਼ਹਿਰ ਵਿੱਚ ਸਤਲੁਜ ਨਦੀ ਹੈ ਜਿੱਥੇ ਕਿ ਮੈਂ ਤੈਰਾਕੀ ਸਿੱਖਦੀ ਹਾਂ